ਸਤਿ ਸ਼੍ਰੀ ਅਕਾਲ ਮੈਮ ਜੀ ਇੰਸਟੀਚਿਊਟ ਤੋਂ ਬੋਲ ਰਹੇ ਹੋ ਜੀ ਮੈਂ ਕਮਲਜੀਤ ਕੌਰ ਬਠਿੰਡਾ ਤੋਂ ਮੈਮ ਮੈਂ ਆਈਲੈਟਸ ਕਰਨੀ ਸੀ ਜੀ ਮੈਮ ਮੈਂ ਇਹ ਪੁੱਛਣਾ ਸੀ ਜੀ ਮਤਲਬ ਇਹ ਕੋਰਸ ਕਿੰਨੇ ਟਾਈਮ ਦਾ ਜੀ ਕਿੰਨੀ ਫੀਸ ਆ ਜੀ

ਜੀ ਅਕਚੂਲੀ ਮੇਰੀ ਫਰੈਂਡ ਸੀ ਉਹਨਾਂ ਨੇ ਕੀਤੀ ਸੀ ਪਹਿਲਾਂ ਇੱਥੇ ਆਈਲੈਟਸ ਉਹਨਾਂ ਨੇ ਦੱਸਿਆ ਸੀ ਕਿ ਬਹੁਤ ਵਧੀਆ ਕਰਾਉਂਦੇ ਆ ਓਕੇ ਓਕੇ ਓਕੇ ਓਕੇ ਮੈਮ ਓਕੇ ਓਕੇ ਮੈਮ ਓਕੇ ਮੈਮ ਓਕੇ ਓਕੇ ਓਕੇ ਮੈਮ ਮੇਰੀ ਸਪੀਕਿੰਗ ਜੀ ਮਤਲਬ ਥੋੜ੍ਹੀ ਜਿਹੀ ਵੀਕ ਸੀ ਮੈਂ ਉਸ ਲਈ ਕਰਨਾ ਸੀ ਜੀ ਵੀ ਐਕਸਟਰਾ ਕਲਾਸਿਸ ਲਗਾਉਣੀਆ ਜਾਂ ਨਹੀਂ ਉਹਦੀ 'ਚ ਜੀ ਓਕੇ ਮੈਮ ਓਕੇ ਅਤੇ ਮੈਮ ਫੀਸ ਦਾ ਪੁੱਛਣਾ ਸੀ ਜੀ ਮਤਲਬ ਵੀ ਇਕੱਠੀ ਭਰਨੀ ਹੈ ਜਾਂ ਇੰਸਟਾਲਮੈਂਟ 'ਚ ਹੋ ਜੂਗੀ ਜੀ

ਓਕੇ ਮੈਮ ਮੈਮ ਕਲਾਸਿਜ਼ ਦਾ ਟਾਈਮ ਕੀ ਹੋਊਗਾ ਜੀ ਓਕੇ ਮੈਮ ਥੈਂਕ ਯੂ ਸੋ ਮੱਚ ਓਕੇ